ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਿਲਕੁਲ ਭਾਅ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਕਿਹੜੀ ਕਿਹੜੀ ਗੱਡੀ ਤੁਹਾਡੇ ਕੋਲ ਭਾਅ ਜੀ ਹੋਂਡਾ ਸੀਟੀ ਜੀ ਅਤੇ ਭਾਅ ਜੀ ਤੁਸੀਂ ਆਰ ਟੀ ਓ ਦੇ ਆਫਿਸ ਤੁਹਾਨੂੰ ਆਉਣਾ ਪੈਣਾ ਉੱਥੇ ਤੁਸੀਂ ਉੱਥੇ ਤੁਸੀਂ ਆਪਣੇ ਜਿਹੜੇ ਗਾਈਡ ਹੋਣਗੇ ਉਹਨਾਂ ਨੂੰ ਮਿਲ ਕੇ ਅਤੇ ਉਹਨਾਂ ਨੂੰ ਤੁਸੀਂ ਇਹ ਚੀਜ਼ ਦੱਸ ਸਕਦੇ ਹੋ ਉਹ ਤੁਹਾਨੂੰ ਫਿਰ ਇੱਕ ਫੋਰਮ ਦੇਣਗੇ ਤੁਸੀਂ ਫੋਰਮ ਫਿੱਲ ਕਰਨਾ ਹੈ ਫੋਮ ਫਿੱਲ ਕਰਨ ਤੋਂ ਬਾਅਦ ਉਹਨਾਂ ਦੀ ਜੋ ਰਿਕੁਆਇਰਮੈਂਟਸ ਹੋਏਗੀ ਤੁਹਾਡਾ ਆਧਾਰ ਕਾਰਡ ਯੇ ਵੋ ਜੋ ਵੀ ਹੈ ਐੱਨ ਓ ਸੀ ਜ਼ਰੂਰ ਲੈ ਕੇ ਆਉਣਾ ਅਤੇ ਤੁਸੀਂ ਕਿਹੜਾ ਨੰਬਰ ਲੈਣਾ ਚਾਹੁੰਦੇ ਹੋ ਉਹ ਤੁਹਾਨੂੰ ਇੱਕ ਨੰਬਰ ਕੰਪਿਊਟਰ ਦੇ ਉੱਪਰ ਦੱਸਣਗੇ ਅਤੇ ਜਿਹੜਾ ਤੁਹਾਨੂੰ ਤੁਹਾਡਾ ਅਗਰ ਤੁਸੀਂ ਮਨਪਸੰਦ ਦਾ ਲੈਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਥੋੜ੍ਹੀ ਜੀ ਪ੍ਰਾਈਜ਼ ਤੁਹਾਨੂੰ ਪਤਾ ਜ਼ਿਆਦਾ ਹੁੰਦੀ ਹੈ ਨਹੀਂ ਭਾਅ ਜੀ ਸਾਡੀ ਕੋਈ ਫੀਸ ਨਹੀਂ ਹੈ ਅਸੀਂ ਤੁਹਾਨੂੰ ਸਿਰਫ ਇੰਨਾਂ ਦੱਸ ਸਕਦੇ ਹਾਂ ਕਿ ਬਈ ਤੁਸੀਂ ਆਰ ਟੀ ਓ ਔਫਿਸ ਆਉਣਾ ਅਤੇ ਉੱਥੇ ਤੁਹਾਨੂੰ ਮੇਰਾ ਹੀ ਇੱਕ ਬੰਦਾ ਮੈਂ ਤੁਹਾਡਾ ਨੰਬਰ ਉਹਨਾਂ ਨੂੰ ਦੇ ਦਾਂਗਾ ਉਹ ਤੁਹਾਨੂੰ ਗਾਈਡ ਕਰਕੇ ਤੁਹਾਨੂੰ ਮੇਨ ਔਫਿਸ ਠੀਕ ਹੈ ਜੀ ਮੈਂ ਦੇ ਦਾਂਗਾ ਠੀਕ ਹੈ ਜੀ ਓਕੇ ਭਾਅ ਜੀ ਆ ਜਾਣਾ ਓਕੇ